ਪੰਜਾਬ ਦੇ ਵਿੱਚ ਬੈਂਕਾਂ ਦੇ ਵਿੱਚ ਮਤਲਬ ਜਿਹੜੇ ਪਿੰਡਾਂ ਦੇ ਲੋਕ ਹੁੰਦੇ ਹਨ ਉਹਨਾਂ ਨੂੰ ਮਤਲਬ ਕਿਆ ਬੈਂਕ ਦੇ ਵਿੱਚ ਜਾ ਕੇ ਬਹੁਤ ਸਾਰੀਆਂ ਪਰੇਸ਼ਾਨੀਆਂ ਆਉਂਦੀਆਂ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਕਿ ਬੈਂਕ ਦੇ ਲੋ ਮਤਲਬ ਬੈਂਕ ਦੇ ਵਿੱਚ ਪੰਜਾਬ ਦੇ ਵਿੱਚ ਬੈਂਕ ਦੇ ਵਿੱਚ ਜਿਹੜੇ ਪਿੰਡਾਂ ਦੇ ਲੋਕ ਆਮ ਜਾਂਦੇ ਹਨ ਜਿਵੇਂ ਕਿ ਤੁਸੀਂ ਔਰਤਾਂ ਨੂੰ ਹੀ ਲਗਾ ਲਓ ਔਰਤਾਂ ਬੈਂਕ ਦੇ ਵਿੱਚ ਜਾਂਦੀਆਂ ਹਨ ਤਾਂ ਜੇ ਉਹਨਾਂ ਨੇ ਪੈਸੇ ਕਢਵਾਉਣੇ ਹੋਣ ਜਾਂ ਪੈਸੇ ਜਮ੍ਹਾ ਕਰਵਾਉਣੇ ਹੋਣ ਤਾਂ ਉਹਨਾਂ ਨੂੰ ਕਿਆ ਏ ਉਹ ਫਾਰਮ ਪੈਸੇ ਕਢਵਾਣੇ ਵਾਲਾ ਅਤੇ ਫਾਰਮ ਪੈਸੇ ਜਮ੍ਹਾਂ ਕਰਵਾਣੇ ਵਾਲਾ ਭਰਨਾ ਨਹੀਂ ਆਉਂਦਾ ਅਤੇ ਮਤਲਬ ਅਜਿਹੀਆਂ ਮਤਲਬ ਕਿਆ ਏ ਜਿਹੜੀਆਂ ਮੁਸ਼ਕਿਲਾਂ ਏ ਅਜਿਹੀਆਂ ਮਤਲਬ ਪਿੰਡਾਂ ਦੇ ਲੋਕਾਂ ਨੂੰ ਪਿੰਡਾਂ ਦੀਆਂ ਔਰਤਾਂ ਨੂੰ ਦੇਖਣੀਆਂ ਪੈਂਦੀਆਂ ਹਨ ਪਿੰਡਾਂ ਦੇ ਆਦਮੀ ਮਤਲਬ ਇਹ ਚੀਜ਼ਾਂ ਸਮਝਦੇ ਹਨ ਉਹਨਾਂ ਨੂੰ ਇਹ ਚੀਜ਼ਾਂ ਭਰਨੀਆਂ ਆਉਂਦੀਆਂ ਹਨ ਇਸ ਲਈ ਕਿਆ ਹੈ ਉਹ ਇਹਨਾਂ ਸਮੱਸਿਆਵਾਂ 'ਤੇ ਮਤਲਬ ਜ਼ਿਆਦਾ ਮਤਲਬ ਉਹਨਾਂ ਦੇ ਇਹ ਚੀਜ਼ਾਂ ਅਸਰ ਨਹੀਂ ਕਰਦੀਆਂ ਪਰੰਤੂ ਜਿਹੜੀਆਂ ਪਿੰਡਾਂ ਦੇ ਅਨਪੜ੍ਹ ਲੋਕ ਹਨ ਪੰਜਾਬ ਦੇ ਮਤਲਬ ਅਨਪੜ੍ਹ ਲੋਕ ਹਨ ਪਿੰਡਾਂ ਦੇ ਅਨਪੜ੍ਹ ਲੋਕ ਹਨ ਪਿੰਡਾਂ ਦੀਆਂ ਅਨਪੜ੍ਹ ਔਰਤਾਂ ਹਨ ਜਿੱਦਾਂ ਕਿ ਹੁਣ ਇਹਨਾਂ ਨੂੰ ਇਹ ਚੀਜ਼ਾਂ ਮਤਲਬ ਇਹ ਸਾ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿੱਦਾਂ ਕਿ ਕੋਈ ਵੀ ਫਾਰਮ ਵਗੈਰਾ ਉਹਨਾਂ ਨੂੰ ਸਮਝ ਨਹੀਂ ਆਉਂਦਾ ਇਸ ਲਈ ਕਿਆ ਏ ਪੰਜਾਬ ਦੇ ਵਿੱਚ ਮਤਲਬ ਬੈਂਕਾਂ ਦੇ ਵਿੱਚ ਅਜਿਹੀ ਮਤਲਬ ਕਿਆ ਏ ਏਜੰਟ ਵਗੈਰਾ ਰੱਖਣੇ ਚਾਹੀਦੇ ਹਨ ਅਜਿਹੇ ਵਰਕਰਜ਼ ਰੱਖਣੇ ਚਾਹੀਦੇ ਹਨ ਜੇ ਪੰਜਾਬ ਦੇ ਵਿੱਚ ਮਤਲਬ ਜਿਹੜੇ ਉਹ ਪਿੰਡਾਂ ਦੇ ਲੋਕ ਹੈ ਕੋਈ ਵੀ ਲੋਕ ਹੈ ਮਤਲਬ ਜੋ ਅਨਪੜ੍ਹ ਹੈ ਉਹਨਾਂ ਨੂੰ ਫਾਰਮ ਨਹੀਂ ਭਰਨੇ ਆਉਂਦੇ ਹਨ ਤਾਂ ਉਹ ਜਿਹੜੇ ਲੋਕ ਹੈ ਉਹ ਮਤਲਬ ਜਾ ਕੇ ਹੈਲਪ ਲੈ ਸਕਣ ਉਹਨਾਂ ਤੋਂ ਅਤੇ ਜਿਹੜੀ ਉਹਨਾਂ ਦੀ ਹੈਲਪ ਹੋਵੈ ਅਤੇ ਹੈਲਪ ਹੋਣ ਦੇ ਨਾਲ ਨਾਲ ਮਤਲਬ ਉਹ ਜਿਹੜੇ ਉਹਨਾਂ ਦੇ ਫਾਰਮ ਆ ਜਿਹੜਾ ਉਹ ਬੈਂਕ ਨੇ ਜਿਹੜਾ ਉਹ ਅਸਿਸਟੈਂਟ ਰੱਖਿਆ ਏ ਬੈਂਕ ਨੇ ਜਿਹੜਾ ਉਹ ਵਰਕਰ ਰੱਖਿਆ ਏ ਉਹ ਵਰਕਰ ਉਹਨਾਂ ਦੀ ਜਿਹੜੀ ਮਦਦ ਕਰ ਸਕੇ